ਮੈਨੂੰ ਬਾਗਬਾਨੀ ਕਰਨ ਦਾ ਛੋਟੇ ਹੁੰਦਿਆਂ ਤੋਂ ਹੀ ਸ਼ੌਂਕ ਸੀਗਾ ਮੇਰੇ ਦਾਦਾ ਜੀ ਸੀਗੇ ਜੋ ਉਹ ਬਾਗਬਾਨੀ ਕਰਦੇ ਸਨ ਉਹਨਾਂ ਨੂੰ ਵੀ ਬਹੁਤ ਸ਼ੌਂਕ ਸੀਗਾ ਕਿ ਬਗੀਚੇ ਦੇ ਵਿੱਚ ਰੰਗ ਬਿਰੰਗੇ ਜਿਹੜੇ ਨੇ ਉਹ ਫੁੱਲ ਹੋਣ ਜੋ ਸਾਡੇ ਘਰ ਨੂੰ ਵੀ ਚਾਰ ਚੰਨ ਲਗਾਉਂਦੇ ਨੇ ਔਰ ਇਹਨਾਂ ਦੀ ਹਰਿਆਲੀ ਇੰਨੀ ਜ਼ਿਆਦਾ ਖੂਬਸੂਰਤ ਹੁੰਦੀ ਆ ਕਿ ਜੀਅ ਕਰਦਾ ਇਹਨਾਂ ਨੂੰ ਦੇਖੀ ਜਾਈਏ ਔਰ ਅੱਜ ਕੱਲ੍ਹ ਵੈਸੇ ਵੀ ਸੰਸਾਰ ਦੇ ਵਿੱਚ ਜਿਹੜੀ ਆ ਦਰੱਖਤਾਂ ਦੀ ਬਹੁਤ ਜ਼ਿਆਦਾ ਕਟਾਈ ਹੋ ਰਹੀ ਆ ਜਿਹੜੇ ਰੁੱਖ ਆ ਉਹ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ ਔਰ ਜਿਸ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਸਾਡੇ ਸੰਸਾਰ ਦੇ ਵਿੱਚ ਪੈਦਾ ਹੋ ਰਹੀਆਂ ਨੇ ਲੋਕਾਂ ਨੂੰ ਸਾਹ ਦੀਆਂ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਉਹ ਉਹਦਾ ਕਾਰਨ ਇਹੀ ਆ ਕਿ ਸਾਡੇ ਸੰਸਾਰ ਦੇ ਵਿੱਚ ਦਰੱਖਤਾਂ ਦੀ ਰੁੱਖਾਂ ਦੀ ਮਾਤਰਾ ਜਿਹੜੀ ਆ ਉਹ ਘੱਟ ਰਹੀ ਹੈ ਔਰ ਜਿਹੜੀ ਨੈਚੁਰਲ ਜਿਹੜੀ ਔਕਸੀਜਨ ਆ ਉਹਦੀ ਮਾਤਰਾ ਸਾਡੀ ਜ਼ਿੰਦਗੀ ਦੇ ਵਿੱਚ ਘੱਟ ਹੋ ਰਹੀ ਆ ਸੋ ਮੇਰੀ ਮੇਰੇ ਦਾਦਾ ਜੀ ਤੋਂ ਮੇਰੇ ਮੰਮਾ ਨੂੰ ਪਾਪਾ ਨੂੰ ਵੀ ਇਹ ਸ਼ੌਂਕ ਸੀਗਾ ਕਿ ਉਹ ਬਾਗਬਾਨੀ ਕਰਨ ਮੇਰੇ ਦਾਦਾ ਜੀ ਦੀ ਡੈੱਥ ਹੋਣ ਤੋਂ ਬਾਅਦ ਮੇਰੇ ਮੰਮਾ ਜਿਹੜੇ ਸੀਗੇ ਉਹ ਬਾਗਬਾਨੀ ਕਰਦੇ ਸਨ ਉਹ ਤਰ੍ਹਾਂ ਤਰ੍ਹਾਂ ਦੇ ਫੁੱਲ ਬਗੀਚੇ ਦੇ ਵਿੱਚ ਲਗਾਉਂਦੇ ਸਨ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਉਹਨਾਂ ਨੇ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਨਾਂ ਨੇ ਇੱਕ ਵੱਡਾ ਸਾਰਾ ਪਲਾਂਟ ਖਰੀਦਿਆ ਜਿਸ ਦੇ ਵਿੱਚ ਉਹ ਸਪੈਸ਼ਲ ਜਿਹੜੀਆਂ ਨੇ ਸਬਜ਼ੀਆਂ ਹੀ ਲਗਾਉਂਦੇ ਸਨ ਉਹ ਰੰਗ ਬਿਰੰਗੇ ਜਿਹੜੇ ਨੇ ਉਹ ਫੁੱਲ ਲਗਾਉਂਦੇ ਸਨ ਔਰ ਫਲਾਂ ਦੇ ਬੂਟੇ ਲਗਾਉਂਦੇ ਸਨ ਔਰ ਉਹਨਾਂ ਦੀ ਹਰਿਆਲੀ ਜਿਹੜੀ ਆ ਉਹ ਇੰਨੀ ਜ਼ਿਆਦਾ ਦਿਲ ਨੂੰ ਭਾਉਂਦੀ ਆ ਜਦੋਂ ਅਸੀਂ ਉਸਨੂੰ ਦੇਖਦੇ ਹਾਂ ਮੈਂ ਜਦੋਂ ਵੀ ਉਸ ਪਲਾਂਟ ਦੇ ਵਿੱਚ ਜਾਂਦੀ ਹਾਂ ਤਾਂ ਮੈਨੂੰ ਇੰਨੀ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਉਹ ਖੁਸ਼ੀ ਜਿਹੜੀ ਆ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਔਰ ਮੈਨੂੰ ਬਾਗਬਾਨੀ ਦਾ ਇੰਨਾਂ ਸ਼ੌਂਕ ਆ ਕਿ ਮੈਂ ਆਪਣੇ ਘਰ ਦੇ ਵਿੱਚ ਵੀ ਜਿਹੜੇ ਗਮਲੇ ਨੇ ਉਹਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖੂਬਸੂਰਤ ਫੁੱਲ ਲਗਾਏ ਹੋਏ ਨੇ ਔਰ ਉਹਨਾਂ ਦੀ ਮੈਂ ਬਹੁਤ ਹੀ ਦੇਖਭਾਲ ਕਰਦੀ ਹਾਂ ਉਹ ਫੁੱਲ ਜਦੋਂ ਖਿਲਦੇ ਨੇ ਔਰ ਜਦੋਂ ਬਾਰਿਸ਼ ਆਉਂਦੀ ਆ ਬਾਰਿਸ਼ ਦੇ ਨਾਲ ਗਿੱਲੇ ਹੁੰਦੇ ਨੇ ਤੋ ਇੰਨੇ ਜ਼ਿਆਦਾ ਖੂਬਸੂਰਤ ਲੱਗਦੇ ਨੇ ਇੰਨੇ ਜ਼ਿਆਦਾ ਖੂਬਸੂਰਤ ਲੱਗਦੇ ਨੇ ਕਿ ਅਸੀਂ ਉਹਨਾਂ ਫੁੱਲਾਂ ਨੂੰ ਦੇਖ ਕੇ ਅਗਰ ਅਸੀਂ ਕਿਸੇ ਗੱਲ ਤੋਂ ਪਰੇਸ਼ਾਨ ਹਾਂ ਤਾਂ ਅਸੀਂ ਉਹਨਾਂ ਫੁੱਲਾਂ ਨੂੰ ਦੇਖ ਲਈਏ ਉਹਨਾਂ ਗਿੱਲੇ ਫੁੱਲਾਂ ਨੂੰ ਜਿਹੜੇ ਬਰਸਾਤ ਦੇ ਨਾਲ ਗਿੱਲੇ ਹੋਏ ਹੁੰਦੇ ਨੇ ਅਤੇ ਸਾਡਾ ਅੱਧਾ ਸੋਗ ਜਿਹੜਾ ਆ ਅੱਧਾ ਦੁੱਖ ਜਿਹੜਾ ਉਹਨਾਂ ਕੁਦਰਤ ਦੇ ਖੂਬਸੂਰਤੀ ਨੂੰ ਦੇਖ ਕੇ ਖਤਮ ਹੋ ਜਾਂਦਾ ਆ ਸੋ ਮੈਨੂੰ ਬਾਗਬਾਨੀ ਦਾ ਬਹੁਤ ਸ਼ੌਂਕ ਆਪਣੇ ਦਾਦਾ ਜੀ ਤੋਂ ਪੈਦਾ ਹੋਇਆ ਸੀਗਾ ਔਰ ਉਹਨਾਂ ਤੋਂ ਬਾਅਦ ਮੇਰੇ ਜਿਹੜੇ ਮਾਤਾ ਪਿਤਾ ਸੀਗੇ ਉਹ ਇਸ ਇਸ ਦੇ ਵਿੱਚ ਜਿਹੜੇ ਨੇ ਰੁਚੀ ਰੱਖਦੇ ਸੀਗੇ ਉਹਨਾਂ ਵੱਲ ਦੇਖ ਕੇ ਮੈਨੂੰ ਵੀ ਬਾਗਬਾਨੀ ਦਾ ਸ਼ੌਂਕ ਸ਼ੁਰੂ ਹੋਇਆ ਔਰ ਮੈਂ ਆਪਣੇ ਘਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲ ਬੂਟੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਵੇਲ ਬੂਟੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਔਰ ਮੈਂ ਅਕਸਰ ਆਪਣੇ ਮਾਤਾ ਪਿਤਾ ਦੇ ਨਾਲ ਪਲਾਂਟ ਦੇ ਵਿੱਚ ਜਾਇਆ ਕਰਦੀ ਸੀਗੀ ਆਪਣੇ ਰੁੱਖਾਂ ਨੂੰ ਪਾਣੀ ਦੇਣ ਦੇ ਲਈ ਸਬਜ਼ੀਆਂ ਨੂੰ ਪਾਣੀ ਦੇਣ ਦੇ ਲਈ ਫਲਾਂ ਦੇ ਬੂਟਿਆਂ ਨੂੰ ਪਾਣੀ ਦੇਣ ਦੇ ਲਈ ਔਰ ਜਦੋਂ ਮੈਂ ਉਹਨਾਂ ਦੇ ਨਾਲ ਜਾਂਦੀ ਸੀਗੀ ਮੈਨੂੰ ਬਹੁਤ ਖੁਸ਼ੀ ਮਿਲਦੀ ਸੀਗੀ ਔਰ ਮੈਂ ਬਹੁਤ ਹੀ ਦੇਖਭਾਲ ਕਰਦੀ ਸੀਗੀ ਉਹਨਾਂ ਬੂਟਿਆਂ ਦੀ ਮੈਂ ਰੋਜ਼ ਦੇਖਦੀ ਸੀਗੀ ਔਰ ਮੈਂ ਛੋਟੇ ਹੁੰਦਿਆਂ ਜਦੋਂ ਮੈਂ ਹੱਥਾਂ ਦੇ ਨਾਲ ਉਹਨਾਂ ਨੇ ਲਗਾਏ ਸੀਗੇ ਉਦੋਂ ਤੋਂ ਲੈ ਕੇ ਜਦੋਂ ਤੱਕ ਉਹ ਵੱਡੇ ਹੋਏ ਉਦੋਂ ਉਹ ਫਲਾਂ ਨੂੰ ਦੇਣ ਲੱਗੇ ਉਦੋਂ ਤੱਕ ਉਹਨਾਂ ਨੂੰ ਦੇਖਦੀ ਆਈ ਹਾਂ ਔਰ ਮੈਨੂੰ ਬਹੁਤ ਪ੍ਰੇਰਨਾ ਮਿਲਦੀ ਆ ਉਹਨਾਂ ਤੋਂ ਉਹ ਕਦੇ ਵੀ ਹਿੰਮਤ ਨਹੀਂ ਹਾਰਦੇ ਬਲਕਿ ਵੱਧਦੇ ਹੀ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਹੀ ਜਾਂਦੇ ਨੇ ਸੋ ਸਾਨੂੰ ਉਹਨਾਂ ਰੁੱਖਾਂ ਤੋਂ ਪ੍ਰੇਰਨਾ ਮਿਲਦੀ ਆ ਕਿ ਜਿਸ ਤਰ੍ਹਾਂ ਰੁੱਖ ਜਿਹੜੇ ਨੇ ਉਹ ਵੱਧਦੇ ਜਾਂਦੇ ਨੇ ਔਰ ਵੱਧ ਕੇ ਸਾਨੂੰ ਜਿਹੜੇ ਨੇ ਉਹ ਫਲ ਦਿੰਦੇ ਨੇ ਫੁੱਲ ਦਿੰਦੇ ਨੇ ਸਬਜ਼ੀਆਂ ਦਿੰਦੇ ਨੇ ਉਸੇ ਤਰ੍ਹਾਂ ਸਾਨੂੰ ਵੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਹੀ ਰਹਿਣਾ ਚਾਹੀਦਾ ਆ ਦੂਸਰਿਆਂ ਦੇ ਲਈ ਖੁਸ਼ੀ ਦਾ ਕਾਰਨ ਬਣਨਾ ਚਾਹੀਦਾ ਆ ਸਕਾਰਾਤਮਕ ਕਾਰਨ ਬਣਨਾ ਚਾਹੀਦਾ ਦੂਸਰਿਆਂ ਦੇ ਲਈ ਕਿਸੇ ਦੇ ਲਈ ਦੁੱਖ ਦਾ ਕਾਰਨ ਨਹੀਂ ਬਣਨਾ ਚਾਹੀਦਾ ਜਿਸ ਤਰ੍ਹਾਂ ਫੁੱਲਾਂ ਤੋਂ ਔਰ ਰੁੱਖਾਂ ਤੋਂ ਔਰ ਪੇੜ ਪੌਦਿਆਂ ਤੋਂ ਸਾਨੂੰ ਸੁੱਖ ਹੀ ਮਿਲਦਾ ਹੈ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਇਹ ਸਾਡੀ ਜ਼ਰੂਰਤਾਂ ਨੂੰ ਪੂਰੀਆਂ ਕਰਦੇ ਨੇ ਉਸੇ ਤਰ੍ਹਾਂ ਸਾਨੂੰ ਵੀ ਇਹਨਾਂ ਰੁੱਖਾ ਤੋਂ ਪ੍ਰੇਰਣਾ ਮਿਲਦੀ ਹੈ ਇਹ ਸਾਡੇ ਲਈ ਇੱਕ ਮੋਟੀਵੇਸ਼ਨ ਦਾ ਕਾਰਨ ਬਣਦੇ ਨੇ ਕਿ ਸਾਨੂੰ ਵੀ ਦੂਸਰਿਆਂ ਦੇ ਲਈ ਇੱਕ ਸੁੱਖ ਦਾ ਕਾਰਨ ਬਣਨਾ ਚਾਹੀਦਾ ਆ ਨਾ ਕਿ ਕਿਸੇ ਦੇ ਦੁੱਖ ਦਾ ਕਾਰਨ ਬਣਨਾ ਚਾਹੀਦਾ ਆ ਸੋ ਮੈਨੂੰ ਬਹੁਤ ਹੀ ਜ਼ਿਆਦਾ ਲਗਾਵ ਹੈ ਪੇੜ ਪੌਦਿਆਂ ਦੇ ਨਾਲ ਫਲਾਂ ਫੁੱਲਾਂ ਇਹਨਾਂ ਸਭ ਰੁੱਖਾਂ ਦੇ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਲਗਾਵ ਹੈ ਮੈਨੂੰ ਬਹੁਤ ਹੀ ਸ਼ੌਂਕ ਹੈ ਬਾਗਬਾਨੀ ਕਰਨ ਦਾ ਔਰ ਇਹ ਸ਼ੌਂਕ ਮੈਨੂੰ ਮੇਰੇ ਪਰਿਵਾਰ ਦੇ ਵਿੱਚੋਂ ਹੀ ਮਿਲਿਆ ਮੇਰੇ ਪਰਿਵਾਰ ਦੇ ਸਾਰੇ ਹੀ ਮੈਂਬਰ ਹੀ ਜਿਹੜੇ ਨੇ ਉਹ ਕੁਦਰਤ ਦੀ ਖੂਬਸੂਰਤੀ ਦੇ ਨਾਲ ਬਹੁਤ ਹੀ ਪਿਆਰ ਕਰਦੇ ਨੇ ਹਰਿਆਲੀ ਨੂੰ ਬਹੁਤ ਹੀ ਪਸੰਦ ਕਰਦੇ ਨੇ ਔਰ ਔਰ ਉਹ ਹਮੇਸ਼ਾ ਹੀ ਰੰਗ ਬਿਰੰਗੇ ਬੂਟੇ ਤਰ੍ਹਾਂ ਤਰ੍ਹਾਂ ਦੇ ਜੋ ਫਲ ਫੁੱਲ ਇਹਨਾਂ ਦੇ ਰੁੱਖਾਂ ਨੂੰ ਖਰੀਦਦੇ ਹੀ ਰਹਿੰਦੇ ਨੇ ਔਰ ਆਪਣੇ ਪਲਾਂਟਾਂ ਦੇ ਵਿੱਚ ਜਿਹੜਾ ਨੇ ਉਹ ਲਗਾਉਂਦੇ ਰਹਿੰਦੇ ਨੇ ਔਰ ਮੈਂ ਵੀ ਉਹਨਾਂ ਦੀ ਪੂਰੀ ਮਦਦ ਕਰਦੀ ਹਾਂ ਔਰ ਮੈਂ ਵੀ ਤਰ੍ਹਾਂ ਤਰ੍ਹਾਂ ਦੇ ਫੁੱਲ ਫਲ ਔਰ ਵੇਲਾਂ ਜਿਹੜੀਆਂ ਹੁੰਦੀਆਂ ਨੇ ਖੂਬਸੂਰਤ ਉਹ ਮੈਂ ਲਿਆ ਕੇ ਆਪਣੇ ਘਰਾਂ ਦੇ ਵਿੱਚ ਔਰ ਪਲਾਂਟ ਦੇ ਵਿੱਚ ਵੀ ਮੈਂ ਵੱਡੀ ਮਾਤਰਾ ਦੇ ਵਿੱਚ ਲਗਾਉਂਦੀ ਹਾਂ ਔਰ ਉਹਨਾਂ ਦੀ ਦੇਖਭਾਲ ਕਰਦੀ ਹਾਂ ਔਰ ਚੰਗੀ ਦੇਖਭਾਲ ਦੇ ਨਤੀਜੇ ਵਜੋਂ ਉਹ ਚੰਗਾ ਫਲ ਲੈ ਕੇ ਆਉਂਦੇ ਨੇ ਔਰ ਜਦੋਂ ਉਹ ਫਲ ਲੈ ਕੇ ਆਉਂਦੇ ਨੇ ਮੈਨੂੰ ਉਹਨਾਂ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਮਿਲਦੀ ਹੈ ਮੈਂ ਬਹੁਤ ਉਤਸ਼ਾਹਿਤ ਹੁੰਦੀ ਆ ਉਤਸੁਕ ਹੁੰਦੀ ਆ ਉਹਨਾਂ ਨੂੰ ਦੇਖ ਕੇ ਔਰ ਇਸ ਤਰ੍ਹਾਂ ਮੈਨੂੰ ਬਹੁਤ ਹੀ ਜ਼ਿਆਦਾ ਜਿਹੜਾ ਆ ਸ਼ੌਂਕ ਬਾਗਬਾਨੀ ਦਾ ਮੇਰੇ ਅੰਦਰ ਪੈਦਾ ਹੋਇਆ ਆਪਣੇ ਪਰਿਵਾਰ ਤੋਂ ਹੀ